ਹੈਲੋ ਭਾਅ ਜੀ ਮੈਂ ਨਾ ਫਲਿੱਪਕਾਰਟ ਤੋਂ ਨਾ ਮਾਮਾਅਰਥ ਦੀ ਕਿੱਟ ਮੰਗਵਾਈ ਹੈ ਪਹਿਲਾਂ ਤਾਂ ਜਦੋਂ ਮੈਂ ਕਿੱਟ ਖੋਲ੍ਹੀ ਹੈ ਉਹਦਾ ਸਾਰਾ ਸਮਾਨ ਹੀ ਖਿੱਲਰਿਆ ਵਿੱਖਰਿਆ ਹੋਇਆ ਜਿਵੇਂ ਕਿ ਮੈਨੂੰ ਕਿੱਟ ਵੇਖ ਕੇ ਹੀ ਪਹਿਲਾਂ ਮਜ਼ਾ ਨਹੀਂ ਆਇਆ ਪਰ ਜਦੋਂ ਮੈਂ ਕਿੱਟ ਨੂੰ ਯੂਜ਼ ਕੀਤਾ ਉਹਨੂੰ ਲਗਾਇਆ ਅਤੇ ਉਹਦੇ ਮੇਰੀ ਸਾਰੀ ਸਕਿੱਨ ਹੀ ਦੇਖੋ ਖ਼ਰਾਬ ਹੋ ਗਈ ਸਭ ਕੁਛ ਹੀ ਮੇਰੀ ਸਕਿੱਨ ਦਾ ਤਾਂ ਬਸ ਹੀਲਾ ਵਸੀਲਾ ਹੀ ਵਿਗੜ ਗਿਆ ਪਹਿਲਾਂ ਤਾਂ ਮੈਨੂੰ ਡਿਲੀਵਰੀ ਲੈਣ ਲੱਗਿਆ ਵੀ ਦਸ ਪੰਦਰਾਂ ਮਿੰਟ ਲੱਗੇ ਉਹ ਕਦੇ ਉਹ ਡਿਲੀਵਰੀ ਲੈਣ ਵਾਲਾ ਮੁੰਡਾ ਆਇਆ ਉਹ ਕਹਿੰਦਾ ਕਦੇ ਇੱਧਰ ਆਓ ਕਦੇ ਇੱਧਰ ਆਓ ਮੈਂ ਕਦੇ ਇੱਧਰ ਗਈ ਕਦੇ ਉੱਧਰ ਗਈ ਉਹ ਹੀ ਨਹੀਂ ਕਦੇ ਉਹਨੇ ਕੋਲ ਨਹੀਂ ਪਿੱਕਅਪ ਕੀਤੀ ਕਦੇ ਉਹਨੇ ਕੁਛ ਨਹੀਂ ਕੀਤਾ ਬਸ ਮੈਂ ਤਾਂ ਇਹੀ ਉਡੀਕਦੀ ਰਹੀ ਅਤੇ ਜਦੋਂ ਇੰਨੀ ਉਡੀਕਾਂ ਨਾਲ ਮੈਂ ਕਿੱਟ ਪਾਈ ਉਹ ਤਾਂ ਮੈਨੂੰ ਵਧੀਆ ਹੀ ਨਹੀਂ ਲੱਗੀ ਫਿਰ ਮੈਂ ਖੋਲ੍ਹੀ ਮੇਰਾ ਮੂਡ ਤਾਂ ਉੱਥੇ ਹੀ ਖ ਭਾਅ ਜੀ ਖ਼ਰਾਬ ਹੋ ਗਿਆ ਤੁਹਾਡੇ ਹੋਰ ਵੀ ਪ੍ਰੋਡ ਪ੍ਰੋਡਕਟ ਤੁਹਾਡੇ ਤੋਂ ਮੰਗਵਾਈ ਦੇ ਪਰ ਇਹ ਪ੍ਰੋਡਕਟ 'ਤਾਂ ਬਸ ਇਹ ਤਾਂ ਮੈਂ ਆਪਣੇ ਇੰਨੇ ਸ਼ੌਕ ਨਾਲ ਮੰਗਾਵਾਇਆ ਇੰਨੇ ਪੈਸੇ ਇਕੱਠੇ ਕਰਕੇ ਮੰਗਾਵਾਏ ਤੁਸੀਂ ਤਾਂ ਇੰਨਾ ਭੈੜਾ ਪ੍ਰੋਡਕਟ ਭੇਜ ਦਿੱਤਾ ਫਿਰ ਮੈਂ ਯੂਜ਼ ਕੀਤਾ ਮੇਰੀ ਤਾਂ ਸਾਰੀ ਸਕਿੱਨ 'ਤੇ ਦੇਖੋ ਹਜੇ ਤੱਕ ਮੈਂ ਹੋਰ ਕਰੀਮਾਂ ਲਾ ਲਾ ਕੇ ਠੀਕ ਕਰ ਰਹੀ ਹਾਂ ਮੈਂ ਤਾਂ ਹੋਰ ਜਣਿਆਂ ਨੂੰ ਕੋਈ ਸਗੋਂ ਕਹਿਣਾ ਸੀ ਕਿ ਤੁਸੀਂ ਮਾਮਾਅਰਥ ਦੀ ਕਿੱਟ ਮੰਗਵਾਉਣਾ ਅਤੇ ਉਹ ਮੈਨੂੰ ਕਹਿ ਰਹੇ ਸੀ ਪਹਿਲਾਂ ਤੂੰ ਵਰਤ ਕੇ ਦੇਖੀ ਫਿਰ ਮੈਂ ਦੇਖਾਂਗਾ ਕਿ ਕਿਹੋ ਜਿਹੀ ਮੈਂ ਤਾਂ ਹੋਰ ਵੀ ਆਪਣੇ ਕਈ ਫਰੈਂਡਸ ਨੂੰ ਕਿਹਾ ਸੀ ਉਹ ਕਹਿੰਦੇ ਤੁਸੀਂ ਪਹਿਲਾਂ ਤੂੰ ਯੂਜ ਕਰਕੇ ਦੇਖੀ ਫਿਰ ਆਪਾਂ ਕਰਕੇ ਦੇਖ ਲਾਂਗੇ ਕਿ ਇਹ ਕਿੱਟ ਵਧੀਆ ਹੈ ਕਿ ਨਹੀਂ ਵਧੀਆ ਪਰ ਮੈਂ ਯੂਜ਼ ਕੀਤੀ ਮੈਨੂੰ ਤਾਂ ਇਹਦੇ ਵਿੱਚ ਕੋਈ ਭਾਅ ਜੀ ਵਧੀਆ ਲੱਗਾ ਹੀ ਨਹੀਂ ਮੈਂ ਤਾਂ ਇੰਨੇ ਸ਼ੌਕ ਨਾਲ ਮੰਗਵਾਈ ਸੀ ਮਸਾ ਮਸਾ ਮੈਂ ਪੈਸੇ ਇਕੱਠੇ ਕੀਤੇ ਸ਼ੌਕ ਨਾਲ ਮੰਗਵਾਈ ਉਹ ਵੀ ਮੇਰਾ ਮੂਡ ਖ਼ਰਾਬ ਕਰਕੇ ਰੱਖ ਦਿੱਤਾ ਤੁਸੀਂ ਬਸ ਹੁਣ ਮੈਂ ਇਹੀ ਕਹਿਣਾ ਚਾਹੁੰਦੀ ਹਾਂ ਕਿ ਤੁਸੀਂ ਜਾਂ ਤਾਂ ਮੈਨੂੰ ਕਿੱਟ ਦੇ ਬਦਲੇ ਕੋਈ ਹੋਰ ਸਮਾਨ ਭੇਜ ਦਿਉ ਕੁਛ ਹੋਰ ਭੇਜੋ ਠੀਕ ਹੈ ਨਾ ਹੋਰ ਕੁਛ ਮੈਂ ਔਰਡਰ ਕਰ ਦਿੰਦੀ ਮੈਨੂੰ ਕੁਛ ਹੋਰ ਭੇਜ ਦਿਉ ਅਤੇ ਜਿਹੜੇ ਹੋਰ ਜਿਹੜੇ ਮੰਗਵਾ ਰਹੇ ਹਾਂ ਉਹਨਾਂ ਨੂੰ ਤਾਂ ਮੈਂ ਕਹਿ ਦੇਣਾ ਕਿ ਇਹ ਤਾਂ ਮੰਗਵਾਓ ਨਾ ਮੈਂ ਥੱਲੇ ਕਮੈਂਟ 'ਚ ਲਿਖ ਦੇਣਾ ਹੈ ਇਹ ਤਾਂ ਬਿਲਕੁਲ ਹੀ ਨਹੀਂ ਵਧੀਆ ਹੈਗੀ ਹੈ ਮਾਮਾਅਰਥ ਦੀ ਕਿੱਟ ਅਤੇ ਬਸ ਜੀ ਓਕੇ